ਹੈਲੋ ਗੁਡ ਆਫਟਰਨੂਨ ਸਰ ਗੁਪਤਾ ਟਰੈਵਲ ਏਜੰਸੀ ਤੋਂ ਮੈਂ ਕੁਝ ਸਮੇਂ ਪਹਿਲਾਂ ਕੈਬ ਬੁੱਕ ਕੀਤੀ ਸੀ ਲਗਭਗ ਅੱਧੇ ਘੰਟੇ ਪਹਿਲਾਂ ਅਤੇ ਮੇਰੀ ਇੱਕ ਅਪੀਲ ਸੀ ਤੁਹਾਡੀ ਏਜੰਸੀ ਤੋਂ ਕਿ ਮੈਂ ਅਜੀਤ ਨਗਰ ਪਿੱਕਅਪ ਜਗ੍ਹਾ ਰੱਖੀ ਸੀ ਆਪਣੀ ਪਰ ਹੁਣ ਮੈਂ ਭਗਤ ਸਿੰਘ ਨਗਰ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਭਗਤ ਸਿੰਘ ਨਗਰ ਤੋਂ ਹੀ ਚੁੱਕਿਆ ਜਾਵੇ ਹੁਣ ਅਤੇ ਕੈਬ ਨੂੰ ਕਿਹਾ ਜਾਵੇ ਤੁਹਾਡੇ ਵੱਲੋਂ ਅਤੇ ਇਸਦੀ ਜੋ ਵੀ ਐਕਸਟਰਾ ਚਾਰਜਸ ਨੇ ਉਹ ਮੈਂ ਦੇਣ ਨੂੰ ਤਿਆਰ ਹਾਂ ਅਤੇ ਮੈਂ ਤੁਹਾਡੀ ਬਹੁਤ ਧੰਨਵਾਦ ਹੋਵਾਂਗੀ ਜੇ ਤੁਸੀਂ ਮੇਰੀ ਇਹ ਅਪੀਲ ਮਨਜ਼ੂਰ ਕੀਤੀ ਅਤੇ ਮੈਨੂੰ ਜ਼ਰੂਰ ਦੱਸਿਆ ਜਾਵੇ ਕਿੰਨੀ ਇਸਦੀ ਐਕਸਟਰਾ ਚਾਰਜਿਜ ਨੇ ਧੰਨਵਾਦ